ਫੁੱਲ ਸਬਜ਼ੀਆਂ ਵਾਲੇ ਪੌਦੇ ਜਿਹੜੇ ਹੁੰਦੇ ਨੇ ਵੇਲਾਂ ਸਬਜ਼ੀਆਂ ਦੀਆਂ ਵੇਲਾਂ ਇਹ ਜ਼ਿਆਦਾਤਰ ਗਰਮੀ ਵਿੱਚ ਨਹੀਂ ਲੰਮਾ ਟਾਈਮ ਚੱਲਦੀਆਂ ਇਹਨਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਫੁੱਲਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਜ਼ਿਆਦਾ ਗਰਮੀ ਨਾਲ ਇਹ ਸਬਜ਼ੀਆਂ ਵਾਲੀਆਂ ਜਿਹੜੀਆਂ ਵੇਲਾਂ ਹੁੰਦੀਆਂ ਨੇ ਪੌਦੇ ਹੁੰਦੇ ਨੇ ਉਹ ਜ਼ਿਆਦਾ ਟਾਈਮ ਗਰਮੀ ਨਹੀਂ ਲੈ ਸਕਦੇ ਹੈਗੇ ਉਹ ਗਰਮੀ 'ਚ ਮੁਜਰਾ ਮੁਰਝਾ ਜਾਂਦੇ ਨੇ ਸੁੱਕ ਜਾਂਦੇ ਨੇ ਇਸ ਲਈ ਉਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਉਹਨਾਂ ਵਿੱਚ ਪਾਣੀ ਪਾਉਣਾ ਸਮੇਂ ਸਿਰ ਉਹਨਾਂ ਦੀ ਦੇਖਭਾਲ ਕਰਨਾ ਧੁੱਪ ਤੋਂ ਬਚਾਉਣ ਲਈ ਉਹਨਾਂ ਉੱਪਰ ਪੋਲੀਥੀਨ ਨਾਲ ਉਹਨਾਂ ਨੂੰ ਕਵਰ ਕਰਨਾ ਇਸ ਕਰਕੇ ਇਹੀ ਜ਼ਿਆਦਾਤਰ ਇਹ ਪੌਦੇ ਸੋਹਲ ਹੁੰਦੇ ਹਨ ਇਹਨਾਂ ਦੀ ਜ਼ਿਆਦਾਤਰ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਇਹਨਾਂ ਨੂੰ ਜ਼ਿਆਦਾਤਰ ਪਾਣੀ ਦੇਣਾ ਸਮੇਂ ਸਮੇਂ ਸਿਰ ਇਹਨਾਂ ਦੀ ਦੇਖਭਾਲ ਕਰਨਾ ਇਹਨਾਂ ਨੂੰ ਜ਼ਿਆਦਾ ਧੁੱਪ 'ਚ ਨਾ ਰੱਖਣਾ ਇਹਨਾਂ ਦੀ ਧੁੱਪ ਤੋਂ ਕੇਅਰ ਕਰਨਾ ਸੰਭਾਲ ਕਰਨਾ ਇਸ ਲਈ ਇਹ ਪੌਦੇ ਜ਼ਿਆਦਾਤਰ ਗਰਮੀ ਨਹੀਂ ਝੱਲ ਸਕਦੇ ਹੈਗੇ